ਹੈਲੋ ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਇੰਮਪੋਲਾਇਮੈਂਟ ਆਫ਼ਿਸ ਤੋਂ ਜੀ ਬੋਲਦੇ ਹਾਂਜੀ ਸਰ ਮੈਂ ਨਾ ਆਪਣੀ ਜੌਬ ਬਾਰੇ ਪਤਾ ਕਰਨਾ ਸੀ ਤੁਹਾਡੇ ਕੋਲ ਕਿਹੜੀ ਕਿਹੜੀ ਜੌਬ ਹੈ ਜੀ ਮੈਂ ਆਈ ਟੀ ਆਈ ਕੀਤੀ ਹੋਈ ਹੈ ਇਲੈਕਟ੍ਰੀਸ਼ਨ

ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ

ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਕੀ ਸੈਲਰੀ ਕੀ ਹੈ ਸੈਲਰੀ ਹਾਂਜੀ ਠੀਕ ਹੈ ਜੀ ਠੀਕ ਹੈ

ਠੀਕ ਹੈ ਜੀ ਠੀਕ ਹੈ

ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਚੱਲੋ ਮੈਂ ਤੁਹਾਡੇ ਨਾਲ ਕੰਨਟੈਕਟ ਕਰ ਲਵਾਂਗਾ ਜਿਵੇਂ ਵੀ ਹੋਇਆ ਠੀਕ ਹੈ ਠੀਕ ਹੈ ਜੀ ਓਕੇ ਜੀ ਓਕੇ ਓਕੇ ਓਕੇ